ਹੈਲੋ ਮੇਰੀ ਬਦਲੀ ਬਠਿੰਡਾ ਹੋ ਗਈ ਹੈ ਅਤੇ ਅਸੀਂ ਬੱਚਿਆਂ ਸਣੇ ਘੁੰਮਣ ਲਈ ਬਠਿੰਡਾ ਆਉਣਾ ਚਾਹੁੰਦੇ ਹਨ ਅਤੇ ਬਠਿੰਡੇ ਵਿੱਚ ਬੱਚਿਆਂ ਵਾਸਤੇ ਕਿਹੜੀ ਕਿਹੜੀ ਜਗ੍ਹਾ ਘੁੰਮਣ ਯੋਗ ਹਨ ਅਤੇ ਇਹ ਸਾਨੂੰ ਦੱਸਿਆ ਜਾਵੇ ਹਾਂਜੀ ਹਾਂਜੀ ਅੱਜ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ